ਸਪੈਂ ਸਟੈਂਪ ਅਤੇ ਸਿੱਕਿਆਂ ਨੂੰ ਇਕੱਠੇ ਕਰ ਕੇ ਅਸੀਂ ਮਿਊਜਿਅਮ ਵਿੱਚ ਰੱਖ ਦਿੰਦੇ ਹਾਂ ਜਿਸ ਤੋਂ ਬਾਅਦ ਸਾਨੂੰ ਕਿੰਨੇ ਸਾਲਾਂ ਬਾਅਦ ਵੀ ਸਾਨੂੰ ਪਤਾ ਲੱਗ ਸਕਦਾ ਵੀ ਸਾਡੀ ਕਰੰਸੀ ਕਹੀ ਕਿਸ ਤਰ੍ਹਾਂ ਦੀ ਸੀ ਜਿਸ ਤੋਂ ਇਸ ਤਰ੍ਹਾਂ ਹੀ ਅੱਜ ਤੋਂ ਅਸੀਂ ਦੋ ਸੌ ਸਾਲ ਚਾਰ ਸੌ ਸਾਲ ਪਹਿਲਾਂ ਪੁਰ ਪਹਿਲਾਂ ਦੇ ਸਿੱਕੇ ਦੇਖਦੇ ਹਾਂ ਤਾਂ ਸਾਨੂੰ ਵੀ ਪਤਾ ਲੱਗਦਾ ਵੀ ਉਸ ਟਾਇਮ ਕਰੰਸੀ ਕਿਹੋ ਜਿਹੀ ਸੀ